ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੂਦਾ ਹੈ ਅਤੇ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਨੂੰ ਅੱਜ ਜਗ੍ਹਾ ਬਾਰੇ ਦੱਸਣਾ ਚਾਹੁੰਦੀ ਹਾਂ ਜਿਵੇਂ ਕਿ ਅੰਮ੍ਰਿਤਸਰ ਅੰਮ੍ਰਿਤਸਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹਨ ਜਿਵੇਂ ਕਿ ਸ਼੍ਰੀ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਵਿੱਚ ਅਸੀਂ ਗੁਰੂ ਜੀ ਦੇ ਦਰਸ਼ਨ ਕਰਦੇ ਹਾਂ ਹੋਰ ਵੀ ਬਹੁਤ ਕੁਛ ਹੈ ਬਾਹਰ ਜਿਵੇਂ ਕਿ ਬਹੁਤ ਮੇਲਾ ਲੱਗਿਆ ਰਹਿੰਦਾ ਹੈ ਉੱਥੇ ਇਸ ਮਤਲਬ ਇੱਦਾਂ ਹੈ ਕਿ ਉੱਥੇ ਹਰ ਟਾਇਮ ਮੇਲਾ ਲੱਗਿਆ ਹੀ ਰਹਿੰਦਾ ਹੈ ਬੰਦਾ ਜਦੋਂ ਮਰਜ਼ੀ ਹੀ ਜਾਵੇ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਜਲੰਧਰ ਹੋ ਗਿਆ ਜਲੰਧਰ ਵਿੱਚ ਵੀ ਕਾਫੀ ਜਿੱਦਾਂ ਕਿ ਦੇਵੀ ਤਲਾਹ ਮੰਦਰ ਹੈ ਓਥੇ ਜਿੱਦਾਂ ਮਾਤਾ ਜੀ ਦੀ ਜ਼ਿਆਦਾ ਅ ਜਗ੍ਹਾ ਐ ਹੈ ਆ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੰਡਰਲੈਂਡ ਦੀ ਜੋ ਕਿ ਜਲੰਧਰ ਵਿੱਚ ਹੈ ਉੱਥੇ ਬੱਚੇ ਮਤਲਬ ਹਰ ਇੱਕ ਫੈਮਲੀ ਕੋਈ ਵੀ ਜਾ ਸਕਦਾ ਹੈ ਮਜ਼ੇ ਕਰਨ ਜਿਵੇਂ ਕਿ ਸਵਿਮਿੰਗ ਪੂਲ ਕਾਫ਼ੀ ਕੁਛ ਹੈ ਉੱਥੇ ਮਤਲਬ ਮਜ਼ੇ ਕਰਨ ਲਈ ਪਰ ਸਾਨੂੰ ਇੱਦਾਂ ਦੀ ਜਗ੍ਹਾ 'ਤੇ ਮਤਲਬ ਪਠਾ ਪੰਜਾਬ ਵਿੱਚ ਇੱਦਾਂ ਦੀ ਜਗ੍ਹਾ ਹੈ ਤਾਂ ਬਹੁਤ ਨੇ ਘੁੰਮਣ ਵਾਲੀਆਂ ਪਰ ਸਾਨੂੰ ਕੁਛ ਕੁਛ ਸਾਵਧਾਨੀਆਂ ਵੀ ਵਰਤਣੀਆਂ ਪੈਣੀਆਂ ਪੈਣੀਆਂ ਜਾ ਸਕਦੀਆਂ ਹਨ ਜਿਵੇਂ ਕਿ ਆਪਾਂ ਕੁਛ ਕਰ ਰਹੇ ਹਾਂ ਠੀਕ ਹੈ ਅਤੇ ਆਪਾਂ ਮਤਲਬ ਜਾ ਰਹੇ ਹਾਂ ਅ ਬਜ਼ਾਰ 'ਚ ਜਾ ਰਹੇ ਹਾਂ ਜਿਵੇਂ ਕਿ ਸਾਨੂੰ ਹਰ ਥਾਂ ਜੇਬ ਕਤਰੇ ਮਿਲ ਜਾਂਦੇ ਹੈ ਓਹ ਕਿ ਹਿੰਦੋਸਤਾਨ ਪੰਜਾਬ ਜਿੱਥੇ ਮਰਜ਼ੀ ਜਾਣ ਜੇਬ ਕਤਰੇ ਮਿਲ ਸਕਦੇ ਹਨ ਤਾਂ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿ ਆਪਾਂ ਜੇਬ ਕਤਰਿਆਂ ਤੋਂ ਬਚ ਕੇ ਰਹੀਏ ਕਿ ਸਾਡੀ ਓਹ ਜੇ ਕਿਤੇ ਪੈਸੇ ਨਾ ਕੱਢ ਲੈਣ ਹੋਰ ਵੀ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਹੈ ਮੈਂ ਤੁਹਾਨੂੰ ਇਹੀ ਸੁਝਾਵ ਦਵਾਂਗੀ ਕਿ ਜਦੋਂ ਵੀ ਤੁਸੀ ਕਿਤੇ ਜਾਂਦੇ ਹੋ ਆਪਣਾ ਮੂੰਹ ਕੰਨ ਸਭ ਕੁਛ ਮਤਲਬ ਚੁੰਨੀ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਆਪਣਾ ਪਰਸ ਸੰਭਾਲ ਕੇ ਰੱਖਣਾ ਚਾਹੀਦਾ ਹੈ